ਪੰਜਾਬ ਵਿੱਚ ਨਿਊਜ਼ ਮੀਡੀਆ ਨਾਲ ਬਹੁਤ ਲੋਕਾਂ ਵਿੱਚ ਜਾਗਰੂਕਤਾ ਆਈ ਹੈ ਨਿਊਜ਼ ਮੀਡੀਆ ਵਾਲੇ ਚੰਗੀਆਂ ਅਤੇ ਮਾੜੀਆਂ ਦੋਵੇਂ ਤਰ੍ਹਾਂ ਦੀਆਂ ਖ਼ਬਰਾਂ ਨੂੰ ਕਵਰ ਕਰਦੇ ਹਨ ਜੇ ਗੱਲ ਕਰੀਏ ਫੂਡ ਅਤੇ ਪਕਵਾਨਾਂ ਦੀ ਤਾਂ ਨਿਊਜ ਚੈਨਲ ਵਾਲੇ ਵੱਖ ਵੱਖ ਰੇਹੜੀਆਂ ਅਤੇ ਹੋਟਲਾਂ 'ਤੇ ਜਾ ਕੇ ਉਹਨਾਂ ਦੇ ਭੋਜਨ ਬਣਾਉਣ ਦਾ ਸਹੀ ਤਰੀਕਾ ਅਤੇ ਸਾਫ਼ ਸਫਾਈ ਦੀਆਂ ਗਤੀਸ਼ੀਲ ਵਿਧੀਆਂ ਨੂੰ ਐਕਟਿਵ ਕਰਕੇ ਅਪਲੋਡ ਕਰਦੇ ਹਨ ਤਾਂ ਜੋ ਲੋਕਾਂ ਦੀ ਸਿਹਤ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਖਿਲਵਾੜ ਨਾ ਹੋ ਸਕੇ ਅਤੇ ਦੂਜੀ ਸਾਈਡ ਦੁਕਾਨਾਂ ਅਤੇ ਰੇਹੜੀ ਵਾਲਿਆਂ ਨੂੰ ਇਸਦਾ ਇਹ ਫਾਇਦਾ ਹੁੰਦਾ ਹੈ ਜੋ ਸਾਫ਼ ਸੁਥਰਾ ਭੋਜਨ ਬਣਾਉਂਦੇ ਹਨ ਗਾਹਕ ਉਹਨਾਂ ਕੋਲ ਜਾ ਕੇ ਪਹੁੰਚ ਜਾਂਦੇ ਹਾਂ ਅਤੇ ਵਧੀਆ ਖਾਣਾ ਖਾਂਦੇ ਹਾਂ ਜਿਸ ਨਾਲ ਉਹਨਾਂ ਦੀ ਸਿਹਤ ਦੇ ਨਾਲ ਕੋਈ ਜਾਨੀ ਮਾਲ ਨੁਕਸਾਨ ਨਹੀਂ ਹੁੰਦਾ ਇਸ ਕਰਕੇ ਸਾਨੂੰ ਇਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੀਦਾ